ਜਦੋਂ ਕੋਈ ਪੇਂਟਿੰਗ ਕਰਦਾ ਹੁੰਦਾ ਸੀ ਤਾਂ ਮੈਨੂੰ ਉਹਨੂੰ ਵੇਖ ਕੇ ਬਹੁਤ ਵਧੀਆ ਲੱਗਦਾ ਸੀ ਤਾਂ ਫਿਰ ਮੈਂ ਵੀ ਸੋਚਿਆ ਵੀ ਮੈਂ ਵੀ ਪੇਂਟਿੰਗ ਕਰਾਂ ਅਤੇ ਮੈਂ ਵੀ ਆਪਣੀ ਖੁਸ਼ੀ ਗਮੀ ਜੋ ਵੀ ਹੈ ਉਹ ਐਕਪ੍ਰੈਸ ਕਰਾਂ ਫਿਰ ਮ ਮੈਨੂੰ ਜਦੋਂ ਮੈਂ ਸਕੂਲ ਟਾਈਮ ਪੜ੍ਹਦੀ ਸੀ ਉਦੋਂ ਸਕੂਲ ਵਿੱਚ ਪੇਂਟਿੰਗ ਕਰਵਾਉਂਦੇ ਸੀ ਮੈਂ ਵੀ ਉਦੋਂ ਪੇਂਟਿੰਗ ਕਰਦੀ ਸੀ ਮੈਨੂੰ ਪੇਂਟਿੰਗ ਕਰਕੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਸੀ ਅਤੇ ਬਸ ਸਕੂਲ ਟਾਈਮ 'ਤੇ ਮੈਨੂੰ ਪਤਾ ਲੱਗਿਆ ਕਿ ਮੈਂ ਪੇਂਟਿੰਗ ਨੂੰ ਪਸੰਦ ਕਰਦੀ ਹਾਂ ਅਤੇ ਵੈਸੇ ਵੀ ਜਦੋਂ ਵੀ ਮੈਂ ਗੁੱਸੇ ਵਿੱਚ ਹੁੰਦੀ ਹਾਂ ਜਾਂ ਫਿਰ ਮੂਡ ਖਰਾਬ ਹੁੰਦਾ ਤਾਂ ਮੈਂ ਪੇਂਟਿੰਗ ਕਰਨਾ ਹੀ ਪਸੰਦ ਕਰਦੀ ਹਾਂ ਅਤੇ ਇਸ ਤਰ੍ਹਾਂ ਇਹ ਹੌਲੀ ਹੌਲੀ ਮੇਰਾ ਸ਼ੌਕ ਵੀ ਬਣ ਗਿਆ ਅਤੇ ਫਿਰ ਮੈਂ ਇਹਨੂੰ ਆਪਣੇ ਇੱਕ ਸ਼ੌਕ ਦੇ ਤੌਰ 'ਤੇ ਇਹਨੂੰ ਅਪਣਾ ਲਿਆ ਹੁਣ ਮੈਂ ਪੇਂਟਿੰਗ ਕਰਦੀ ਹਾਂ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਮੈਂ ਇਹਨੂੰ ਇੰਜੋਏ ਵੀ ਬਹੁਤ ਜ਼ਿਆਦਾ ਕਰਦੀ ਹਾਂ